ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਦਲਜੀਤ ਕੌਰ ਹੈ ਮੈਂ ਇੱਕ ਹਫਤਾ ਪਹਿਲਾਂ ਫਲਿੱਪਕਾਰਟ ਤੋਂ ਇੱਕ ਮੋਬਾਇਲ ਔਡਰ ਕੀਤਾ ਸੀ ਜਿਸ ਦੀ ਡਿਲਵਰੀ ਮੈਨੂੰ ਕੱਲ੍ਹ ਰਾਤ ਨੋ ਵਜੇ ਈਕਾਰਟ ਦੇ ਇੱਕ ਡਿਲਵਰੀ ਏਜੰਟ ਜਿਹਨਾਂ ਦਾ ਨਾਮ ਸ਼ਰਨਦੀਪ ਸਿੰਘ ਸੀ ਉਹਨਾਂ ਨੇ ਦਿੱਤੀ ਅਸਲ 'ਚ ਮੈਂ ਉਹਨਾਂ ਦੀ ਸ਼ਿਕਾਇਤ ਕਰਨਾ ਚਾਹੁੰਦੀ ਸੀ ਤੁਹਾਡੇ ਕੋਲ ਕਿਉਂਕਿ ਉਹਨਾਂ ਦਾ ਰਵੱਈਆ ਮੇਰੇ ਪ੍ਰਤੀ ਬਿਲਕੁਲ ਠੀਕ ਨਹੀਂ ਸੀ ਅਸਲ 'ਚ ਹੋਇਆ ਐਵੇਂ ਕਿ ਜਦੋਂ ਉਹਨਾਂ ਦਾ ਮੈਸੇਜ ਆਇਆ ਕੇ ਡਿਲਵਰੀ ਜੋ ਹੈ ਉਹ ਸਵੇਰੇ ਨੋ ਵਜੇ ਤੋਂ ਲੈ ਕੇ ਛੇ ਵਜੇ ਦੇ ਵਿੱਚ ਕੀਤੀ ਜਾਵੇਗੀ ਪਰ ਉਹ ਸਮ ਸ਼ਾਮ ਛੇ ਵਜੇ ਤੱਕ ਜਦੋਂ ਮੇਰੇ ਪਾਸ ਨਹੀਂ ਪਹੁੰਚੇ ਤਾਂ ਮੈਨੂੰ ਲੱਗਿਆ ਕਿ ਡਿਲਵਰੀ ਮੈਨੂੰ ਨਹੀਂ ਦਿੱਤੀ ਜਾਏਗੀ ਪਰ ਉਹ ਰਾਤ ਅਚਾਨਕ ਹੀ ਨੋ ਵਜੇ ਮੇਰੇ ਫਲੈਟ ਦੇ ਬਾਹਰ ਆ ਗਏ ਅਤੇ ਬਿਨਾਂ ਨੋਕ ਕਰੇ ਹੀ ਅੰਦਰ ਆ ਗਏ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਮੈਂ ਸ਼ਿਕਾਇਤ ਕੀਤੀ ਕਿ ਉਹ ਬਿਨਾਂ ਨੋਕ ਕਰੇ ਮੇਰੇ ਘਰ ਦੇ ਅੰਦਰ ਕਿਵੇਂ ਆ ਗਏ ਤਾਂ ਉਹਨਾਂ ਦਾ ਬੋਲਣ ਦਾ ਬਿਹੇਵੀਅਰ ਬਿਲਕੁਲ ਠੀਕ ਨਹੀਂ ਸੀ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਇਹ ਡਿਲਵਰੀ ਏਜੰਟ ਨੇ ਸ਼ਰਨਦੀਪ ਸਿੰਘ ਜਿਹਨਾਂ ਦੀ ਬਾਕੀ ਡਿਟੇਲ ਵੀ ਮੈਂ ਤੁਹਾਨੂੰ ਦੇ ਦੇਵਾਂਗੀ ਜਿਵੇਂ ਕਿ ਮੋਬਾਇਲ ਨੰਬਰ ਸੀ ਉਹਨਾਂ ਦਾ ਚੁਰਾਸੀ ਇੱਕ ਪੰਝੱਤਰ ਉੱਨੀ ਪੰਜ ਸੋ ਛਿਵੰਜਾ ਅਤੇ ਉਹ ਰਹਿਣ ਵਾਲੇ ਮੇਰੇ ਹੀ ਸ਼ਹਿਰ ਪਟਿਆਲੇ ਦੇ ਨੇ ਅਤੇ ਉਹਨਾਂ ਨੇ ਏ ਇਸ ਬਿਹੇਵੀਅਰ ਕਰਕੇ ਮੇਰਾ ਕਾਫੀ ਜ਼ਿਆਦਾ ਮਾਈਂਡ 'ਤੇ ਮੈਂਟਲ ਹਰਾਸ਼ਮੈਂਟ ਹੋਈ ਮੈਨੂੰ ਅਤੇ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਜੋ ਮੈਨੂੰ ਪਰੋਡਕਟ ਡਿਲੀਵਰ ਕੀਤਾ ਉਹਦੀ ਪੈਕੇਜਿੰਗ ਵੀ ਬਿਲਕੁਲ ਸਹੀ ਨਹੀਂ ਸੀਗੀ ਸੋ ਮੈਂ ਤੁਹਾਡੇ ਈਕਾਰਟ ਕੰਪਨੀ ਨੂੰ ਉਸ ਏਜੰਟ ਦੇ ਪ੍ਰਤੀ ਇੱਕ ਸ਼ਿਕਾਇਤ ਦਰਜ ਕਰਨਾ ਚਾਹੁੰਦੀ ਹਾਂ ਅਤੇ ਇਹ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਸ਼ਿਕਾਇਤ ਨੂੰ ਦਰਜ ਕਰੋਗੇ ਅਤੇ ਉਸ 'ਤੇ ਜਿੰਨੀ ਜਲਦੀ ਹੋ ਸਕੇ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਮੈਨੂੰ ਫੀਡਬੈਕ ਵੀ ਦੇਓਗੇ ਕਿ ਉਹਨਾਂ ਦੇ ਨਾਲ ਤੁਸੀਂ ਕੀ ਕੀਤਾ ਹੈ ਅਤੇ ਮੇਰੀ ਸ਼ਿਕਾਇਤ ਦਾ ਅੱਗੇ ਕੀ ਪ੍ਰੋਸੈਸ ਬਣਿਆ ਹੈ ਥੈਂਕ ਯੂ